ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਹ ਪੁੱਛਿਆ ਹੈ ਕਿ ਕੀ ਔਰਤਾਂ ਹੀ ਖਾਣਾ ਬਣਾ ਸਕਦੀਆਂ ਹਨ ਜੀ ਨਹੀਂ ਔਰਤਾਂ ਖਾਣਾ ਬਣਾਉਂਦੀਆਂ ਤਾਂ ਹਨ ਲੇਕਿਨ ਉਹ ਉਹਨਾਂ ਦਾ ਕੰਮ ਹੈ ਨਾ ਤਾਂ ਉਹਨਾਂ ਦੀ ਉਹ ਮਜਬੂਰੀ ਹੈ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਵਾਸਤੇ ਖਾਣਾ ਬਣਾਉਂਦੀਆਂ ਹਨ ਦੇਖੋ ਜੇ ਅਸੀਂ ਗੱਲ ਕਰੀਏ ਕਿ ਖਾਣਾ ਬਣਾਉਣਾ ਇੱਕ ਔਰਤਾਂ ਦਾ ਹੀ ਕੰਮ ਹੈ ਤਾਂ ਉਹ ਇਸ ਤਰ੍ਹਾਂ ਨਹੀਂ ਹੈ ਖਾਣਾ ਤਾਂ ਕੋਈ ਵੀ ਬਣਾ ਸਕਦਾ ਹੈ ਲੇਕਿਨ ਅਸੀਂ ਖਾਣਾ ਤਾਂ ਬਣਾਉਂਦੇ ਹਾਂ ਕਿ ਸਾਡੇ ਘਰ ਵਿੱਚ ਸਾਡੇ ਮਰਦਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਸ ਸਾਡੇ ਨਾਲ ਸਾਡੀ ਹੈਲਪ ਕਰ ਸਕਣ ਜਾਂ ਸਾਡੀ ਮਦਦ ਕਰ ਸਕਣ ਜੇਕਰ ਅਸੀਂ ਗੱਲ ਕਰਦੇ ਹਾਂ ਆਪਣੇ ਉਹ ਆਦਮੀਆਂ ਦੀ ਤਾਂ ਉਹ ਬਾਹਰ ਦਾ ਕੰਮ ਕਰਦੇ ਹਨ ਜਿਸ ਕਾਰਨ ਉਹਨਾਂ ਕੋਲ ਬਿਲਕੁਲ ਵੀ ਸਮੇਂ ਨਹੀਂ ਹੁੰਦਾ ਕਿ ਉਹ ਸਾਡੀ ਮਦਦ ਕਰ ਸਕਣ ਖਾਣਾ ਬਣਾਉਣ ਵਿੱਚ ਜਾਂ ਘਰ ਦਾ ਕੰਮ ਕਰਨ ਵਿਚ ਖਾਣਾ ਬਣਾਉਣਾ ਇੱਕ ਸਾਡਾ ਕੰਮ ਹੈ ਜਿਸ ਨਾਲ ਸਾਨੂੰ ਆਪਣਾ ਕੰਮ ਬਹੁਤ ਹੀ ਚੰਗਾ ਲੱਗਦਾ ਹੈ ਆਪਣੇ ਬੱਚਿਆਂ ਦਾ ਅਤੇ ਆਪਣਾ ਪੇਟ ਭਰਨ ਵਾਸਤੇ ਅਸੀਂ ਖਾਣਾ ਬਣਾਉਂਦੇ ਹਾਂ ਖਾਣਾ ਬਣਾਉਣਾ ਔਰਤਾਂ ਦਾ ਹੀ ਕੰਮ ਹੈ ਕੰਮ ਹੈ ਖਾਣਾ ਬਣਾਉਣ ਲਈ ਅਸੀਂ ਬਹੁਤ ਸਾਰਾ ਆਪਣਾ ਕੰਮ ਕਰਦੇ ਹਾਂ ਸਾਡੇ ਆਦਮੀ ਸਾਨੂੰ ਬਾਹਰ ਪੈਸਾ ਕਮਾ ਕੇ ਲਿਆ ਕੇ ਦੇਣਗੇ ਉਹਨਾਂ ਦਾ ਕੰਮ ਹੈ ਰਾਸ਼ਨ ਲਿਆ ਕੇ ਦੇਣਾ ਅਤੇ ਅਸੀਂ ਖਾਣਾ ਬਣਾਉਣਾ ਕਿ ਅਸੀਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਆਦਮੀ ਵੀ ਖਾਣਾ ਬਣਾ ਸਕਦੇ ਹਨ ਪਰ ਕਿਹੜੇ ਜਿਹੜੇ ਥੋੜ੍ਹਾ ਸਮਾਂ ਘਰ ਵਿੱਚ ਵਿਹਲੇ ਰਹਿੰਦੇ ਹਨ ਉਹ ਆਦਮੀ ਆਪਣੇ ਔਰਤ ਨਾਲ ਆਪਣੀ ਮਦਦ ਕਰ ਸਕਦੇ ਹਨ ਦੂਸਰਾ ਆਦਮੀ ਕੋਈ ਵੀ ਆਪਣੀ ਔਰਤ ਦੀ ਮਦਦ ਨਹੀਂ ਕਰ ਸਕਦਾ ਖਾਣਾ ਬਣਾਉਣ ਵਿੱਚ ਕਿਉਂ ਕਿਉਂਕਿ ਉਹਨੂੰ ਬਾਹਰ ਦਾ ਹੀ ਬੜਾ ਜ਼ਿਆਦਾ ਕੰਮ ਹੁੰਦਾ ਹੈ ਖਾਣਾ ਬਣਾਉਣਾ ਇੱਕ ਔਰਤਾਂ ਦਾ ਕੰਮ ਹੀ ਨਹੀਂ ਹੈ ਖਾਣਾ ਬਣਾਉਣ ਵਿੱਚ ਆਦਮੀ ਵੀ ਮਦਦ ਕਰ ਸਕਦੇ ਹਨ ਪਰ ਜੇ ਉਹਨਾਂ ਕੋਲ ਸਮੇਂ ਹੋਵੇ ਤੇ ਤਾਂ ਇਸ ਤਰ੍ਹਾਂ ਨਹੀਂ